ਸਾਡੇ ਇਲਾਕੇ ਦੇ ਵਿੱਚ ਪੇਂਡੂ ਖੇਤਰ ਹੋਣ ਕਾਰਨ ਇੱਥੇ ਜਿਹੜੀ ਆ ਖੇਤੀਬਾੜੀ ਦਾ ਜਿਹੜਾ ਵਾ ਉਹ ਬਹੁਤ ਵੱਡਾ ਸਰੋਤ ਆ ਆਮਦਨ ਦੇ ਲਈ ਇਹਦੇ ਵਿੱਚ ਕੀ ਹੈ ਜਿਹੜੇ ਪਿੰਡ ਦੇ ਨੌਜਵਾਨ ਆ ਉਹ ਕੀ ਕਰਦੇ ਨੇ ਬਾਹਰ ਚਲੇ ਜਾਂਦੇ ਨੇ ਹੋਰ ਕੰਮ ਕਾਜ ਦੇ ਲਈ ਅਤੇ ਜਿਹੜੇ ਬਾਕੀ ਜਿਹੜੇ ਇੱਥੇ ਰਹਿ ਜਾਂਦੇ ਲੋਕ ਉਹ ਕੀ ਕਰਦੇ ਨੇ ਖੇਤੀਬਾੜੀ ਦੇ ਨਾਲ ਨਾਲ ਜਿਹੜੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਕਾਜ ਜਿਹੜੇ ਉਹਨਾਂ ਨੇ ਆਪਣੇ ਸ਼ੁਰੂ ਕੀਤੀ ਹੋਏ ਆ ਜਿਵੇਂ ਕਿ ਸਬਜ਼ੀ ਵਗੈਰਾ ਵੇਚਣਾ ਉਸ ਤੋਂ ਇਲਾਵਾ ਕੀ ਆ ਜੇ ਕੋਈ ਸਕੂਟਰ ਵਗੈਰਾ ਪੈਂਚਰ ਲਗਾਉਣ ਵਾਲਾ ਕੰਮ ਕਰਨਾ ਇਲੈਕਟਰੀਸਿਟੀ ਦਾ ਕੋਈ ਕੰਮ ਕਰਨ ਵਾਲਾ ਹੋਵੇ ਕੋਈ ਰਿਪੇਅਰ ਦਾ ਕੰਮ ਕਰਨ ਵਾਲਾ ਹੋਵੇ ਕਈਆਂ ਨੇ ਸੈਲੂਨ ਖੋਲ੍ਹੇ ਹੋਏ ਨੇ ਆਪਣੇ ਰੁਜ਼ਗਾਰ ਨੂੰ ਜਿਹੜਾ ਵਾ ਚਲਾਉਣ ਵਾਸਤੇ ਇਹਦੇ ਨਾਲ ਕੀ ਉਹਨਾਂ ਦਾ ਆਰਥਿਕ ਪੱਖ ਵੀ ਮਜਬੂਤ ਹੁੰਦਾ ਆ ਇਹਦੇ ਨਾਲ ਨਾਲ ਕੀ ਉਹਨਾਂ ਦੇ ਰੁਜ਼ਗਾਰ ਵਿੱਚ ਵੀ ਵਾਧਾ ਹੁੰਦਾ ਆ ਨਾਲੇ ਥੋੜ੍ਹਾ ਬਹੁਤਾ ਪੇਂਡੂ ਜਿਹੜਾ ਖੇਤਰ ਆ ਨਾ ਉਹਦੀ ਵੀ ਜਿਹੜੀ ਡਿਵੈਲਪਮੈਂਟ ਜਿਹੜੀ ਹੋਣੀ ਸਟਾਰਟ ਜਾਂਦੀ ਆ ਉਹਦੇ ਨਾਲ ਕੀ ਆ ਕਿ ਜਿਹੜੇ ਲੋਕ ਆ ਪਿੰਡ ਦੇ ਉਹਨਾਂ ਨੂੰ ਵੀ ਆ ਕਿ ਆਸਾਨੀ ਦੇ ਨਾਲ ਜਿਹੜੀਆਂ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ ਪਿੰਡ ਦੇ ਵਿੱਚ ਅਤੇ ਇਹਦੇ ਨਾਲ ਕੀ ਚੰਗਾ ਸਰੋਤ ਵੀ ਜਿਹੜਾ ਬਣ ਜਾਂਦਾ ਆ ਜਿਹਦੇ ਵਿੱਚ ਕਿ ਪਰਿਵਾਰ ਦਾ ਜਿਹੜਾ ਗੁਜ਼ਾਰਾ ਵਾ ਉਹ ਵੀ ਜਿਹੜਾ ਬਹੁਤ ਚੰਗੀ ਤਰ੍ਹਾਂ ਜਿਹੜਾ ਹੋ ਜਾਂਦਾ ਆ ਇਹਦੇ ਨਾਲ ਨਾਲ ਜਿਹੜੇ ਆ ਕਈ ਜਿਹੜੇ ਲੋਕ ਆ ਉਹ ਰਿਕਸ਼ਾ ਵੀ ਚਲਾਉਂਦੇ ਆ ਜੇ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ 'ਤੇ ਜਾਣ ਵਾਸਤੇ ਕੀ ਆ ਉਹ ਰਿਕਸ਼ਾ ਚਲਾਉਂਦੇ ਨੇ ਉਹਦੇ ਨਾਲ ਵੀ ਕਿ ਚੰਗਾ ਆਮ ਦਾ ਜਿਹੜਾ ਵਾ ਸਰੋਤ ਉਹ ਜਿਹੜਾ ਬਣ ਜਾਂਦਾ ਆ